ਬਿਮਾਰੀਆਂ ਤੋਂ ਬਚਣ ਦੇ ਲਈ ਅਤੇ ਸਿਹਤਮੰਦ ਰਹਿਣ ਦੇ ਲਈ ਅਸੀਂ ਬਹੁਤ ਕੁਝ ਕਰਦੇ ਹਾਂ ਸਾਡੇ ਅੰਮ੍ਰਿਤਸਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਲੋਕ ਸਵੇਰ ਦੀ ਸੈਰ ਨੂੰ ਪਹਿਲਾ ਪ੍ਰਾਥਮਿਕਤਾ ਦਿੰਦੇ ਹਨ ਸਵੇਰ ਦੀ ਸੈਰ ਵੇਲੇ ਹੀ ਉਹ ਸਵੇਰੇ ਸਵੇਰੇ ਜਿਵੇਂ ਅੱਜ ਕੱਲ੍ਹ ਸਰਦੀ ਦਾ ਮੌਸਮ ਚੱਲ ਰਿਹਾ ਹੈ ਗੁੜ ਦੀ ਚਾਹ ਦਾ ਸੇਵਨ ਕਰਦੇ ਹਨ ਜੋ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ ਨਾਲ ਦੇ ਨਾਲ ਹੀ ਉਹ ਬਿਮਾਰੀਆਂ ਤੋਂ ਵੀ ਬਚਣ ਦਿੰਦੀ ਹੈ ਅਤੇ ਉਸ ਚਾਹ ਦੇ ਵਿੱਚ ਉਹ ਕੀ ਕਰਦੇ ਹਨ ਇਕੱਲੀ ਗੁੜ ਦਾ ਸੇਵਨ ਨਹੀਂ ਕਰਦੇ ਨਾਲ ਹੀ ਸੌਂਫ ਇਲਾਇਚੀ ਅਦਰਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਮਿਲਾਉਂਦੇ ਹਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਚਾਹ ਦੇ ਵਿੱਚ ਮਿਲਾਉਣ ਦਾ ਕੀ ਫਾਇਦਾ ਹੋ ਗਿਆ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਕਿ ਉਹ ਸਾਰਾ ਕੁਛ ਜਿਵੇਂ ਅਸੀਂ ਕਹਿੰਦੇ ਹਾਂ ਨਜ਼ਲਾ ਰੇਸ਼ਾ ਉਹਨਾਂ ਤੋਂ ਵੀ ਬਚਾਅ ਰਹਿੰਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਅੰਮ੍ਰਿਤਸਰ ਵਰਗੀ ਜਿਹੜੀ ਬਹੁਤ ਹੀ ਜਿਹਨੂੰ ਕਹੀ ਦਾ ਹੈ ਕਿ ਹਾਂ ਠੰਡ ਦਾ ਪਰਕੋਪ ਉਹਦੇ ਤੋਂ ਵੀ ਬਚਾਉਣ ਦਾ ਤਰੀਕਾ ਮਿਲਦਾ ਹੈ ਨਾਲ ਦੇ ਨਾਲ ਸਵੇਰ ਦੀ ਸੈਰ ਵੀ ਹੋ ਗਈ ਅਤੇ ਨਾਲ ਹੀ ਸਿਹਤ ਦਾ ਵੀ ਕੰਮ ਹੋ ਗਿਆ ਜਿਵੇਂ ਬਜ਼ੁਰਗ ਨੇ ਬਜ਼ੁਰਗਾਂ ਦਾ ਕੀ ਹੈ ਕਿ ਉਹਨਾਂ ਦੇ ਚਾਹ ਘਰ ਬਣੇ ਹੋਏ ਹਨ ਚਾਹ ਘਰ ਕਿਉਂ ਕਿਹਾ ਜਾਂਦਾ ਕਿਉਂਕਿ ਨਾਲੇ ਉਹ ਬਹਿ ਕੇ ਗੱਲਾਂ ਕਰਦੇ ਨਾਲੇ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਅਤੇ ਇੱਕ ਦੂਜੇ ਨੂੰ ਸੋਹਣੀਆਂ ਸੋਹਣੀਆਂ ਖਬਰਾਂ ਵੀ ਅਖਬਾਰਾਂ ਤੋਂ ਪੜ੍ਹ ਕੇ ਸੁਣਾਉਂਦੇ ਹਨ ਇਹ ਇਹਦੇ ਨਾਲ ਸਿਹਤਮੰਦ ਰਹਿਣ ਦੇ ਲਈ ਕੀ ਲੋਕ ਗੁਰਦੁਆਰਾ ਸਾਹਿਬ ਮੰਦਰ ਜਾ ਕੇ ਜਦੋਂ ਆਪਣਾ ਸ਼ੀਸ਼ ਨਿਵਾਉਂਦੇ ਨੇ ਅਤੇ ਉੱਥੋਂ ਦੇ ਅੰਮ੍ਰਿਤ ਜਲ ਦਾ ਜਦੋਂ ਸੇਵਨ ਕਰਦੇ ਨੇ ਉਹਨੂੰ ਗ੍ਰਹਿਣ ਕਰਦੇ ਨੇ ਅਤੇ ਉਹਨਾਂ ਦੇ ਅੰਦਰ ਇੱਕ ਨਵੀਂ ਐਨਰਜੀ ਦਾ ਵਾਸ ਹੁੰਦਾ ਹੈ ਇਹਦੇ ਨਾਲ ਬੱਚਿਆਂ ਨੂੰ ਉਹ ਕੀ ਕਰਦੇ ਨੇ ਜਿਵੇਂ ਤਾਜ਼ੇ ਫਲ ਹੋ ਗਏ ਤਾਜ਼ੀਆਂ ਸਬਜ਼ੀਆਂ ਇਹਨਾਂ ਦਾ ਸੂਪ ਬਣਾ ਤਾ ਤਾਜ਼ੇ ਫਲਾਂ ਦਾ ਜੂਸ ਦੇ ਦਿੱਤਾ ਬਿਮਾਰ ਹੋਣ ਬਜ਼ੁਰਗ ਹੋਣ ਉਹਨਾਂ ਨੂੰ ਵੀ ਅਤੇ ਇਹ ਸਭ ਕੁਛ ਅਸੀਂ ਪੰਜਾਬ ਦੇ ਵਿੱਚ ਆਮ ਤੌਰ 'ਤੇ ਵੀ ਕਰਦੇ ਹਾਂ ਅਤੇ ਖਾਸ ਕਰ ਗਰਮੀਆਂ ਅਤੇ ਸਰਦੀਆਂ ਦਾ ਅਪਣੇ ਹਿਸਾ ਮੌਸਮ ਦੇ ਹਿਸਾਬ ਨਾਲ ਵੀ ਕੀਤਾ ਜਾਂਦਾ ਹੈ